ਬਗੀਚਾ ਜੋ ਅਸੀਂ ਆਪਣੇ ਘਰ ਦੇ ਵਿਹੜੇ ਦੇ ਵਿੱਚ ਦੀਵਾਰ ਦੇ ਸਾਈਡ 'ਤੇ ਘਰ ਦੇ ਵਿਚਾਲੇ ਨੀਂਹ ਪਾਸੇ 'ਤੇ ਬਣਾਉਂਦੇ ਹਾਂ ਜਿਹਦੇ ਨਾਲ ਪਾਣੀ ਦੀ ਔਰ ਆਵਾਜਾਈ ਬਾਹਰ ਅੰਦਰ ਜਾਣ ਦੀ ਸਾਨੂੰ ਕੋਈ ਦਿੱਕਤ ਪੇਸ਼ ਨਹੀਂ ਹੁੰਦੀ ਉਹਦੇ ਨਾਲ ਇਸ ਤਰ੍ਹਾਂ ਦਾ ਬਣਾ ਦਿੰਦੇ ਹਾਂ ਕਿ ਪਾਣੀ ਵਗੈਰਾ ਬਗੀਚੇ ਦੇ ਵਿੱਚ ਆਰਾਮ ਨਾਲ ਲੱਗ ਸਕੇ ਔਰ ਜਿੱਥੋਂ ਵੀ ਪਾਣੀ ਆਉਂਦਾ ਹੈ ਬਗੀਚੇ ਦੇ ਵਿੱਚ ਉਹ ਜਗ੍ਹਾ 'ਤੇ ਅਸੀਂ ਇੱਕ ਛੋਟਾ ਜਿਹਾ ਚੁਬੱਚਾ ਜਿਹਾ ਬਣਾ ਦਿੰਦੇ ਹਾਂ ਜਿਹਦੇ ਵਿੱਚ ਪਾਣੀ ਆ ਆ ਕੇ ਪਈ ਜਾਂਦਾ ਔਰ ਉਸ ਤੋਂ ਬਾਅਦ ਬਗੀਚੇ ਦੇ ਵਿੱਚ ਪਈ ਜਾਂਦਾ ਹੈ ਪਾਣੀ ਜਦੋਂ ਵੀ ਕਿਤੇ ਗੋਡੀ ਵਗੈਰਾ ਕਰਨੀ ਹੁੰਦੀ ਹੈ ਬਗੀਚੇ ਦੇ ਵਿੱਚ ਅਸੀਂ ਆਪਣੇ ਹੱਥਾਂ ਨਾਲ ਹੀ ਕਰਦੇ ਹਾਂ ਪਾਣੀ ਵਗੈਰਾ ਵੀ ਆਪਣੇ ਕੋਲ ਖੜ੍ਹ ਕੇ ਹੱਥਾਂ ਨਾਲ ਜਿੰਨਾ ਜ਼ਰੂਰਤ ਦੇ ਮੁਤਾਬਕ ਦੇਣਾ ਹੈ ਪਾਣੀ ਓਨਾ ਹੀ ਅਸੀਂ ਉਹਨਾਂ ਨੂੰ ਪਾਣੀ ਦਿੰਦੇ ਹਾਂ ਬਾਕੀ ਰਹੀ ਗੱਲ ਸਾਲ ਸਾਂਭ ਸੰਭਾਲ ਦੀ ਸਾਂਭਣ ਵਾਸਤੇ ਕਦੇ ਦੂਜੇ ਆਦਮੀ ਨੂੰ ਜਾਂ ਕਿਸੇ ਨੌਕਰ ਨੂੰ ਵਗੈਰਾ ਅਸੀਂ ਉਹਦੇ 'ਤੇ ਭਰੋਸਾ ਨਹੀਂ ਕਰਦੇ ਕੋਈ ਸਪਰੇਅ ਵਗੈਰਾ ਕਰਨੀ ਹੈ ਤਾਂ ਵੀ ਆਪਣੇ ਹੱਥਾਂ ਨਾਲ ਅਤੇ ਆਪ ਹੀ ਉਸ ਦੀ ਸੰਭਾਲਣੀ ਹੈ ਵਿਹੜੇ ਦੇ ਵਿੱਚ ਥੱਲੇ ਬਣਾਉਂਦੇ ਹਾਂ ਛੱਤ ਦੇ ਉੱਤੇ ਨਹੀਂ ਬਗੀਚਾ ਬਣਾਉਂਦੇ